ਹਾਂਜੀ ਰੋਪੜ ਏਜੰਸੀ 'ਚੋਂ ਬੋਲਦੇ ਜੀ ਹਾਂ ਸਰ ਆਪਾਂ ਨੂੰ ਗੱਡੀ ਚਾਹੀ ਸੀਗੀ ਗੱਡੀ ਚਾਹੀਦੀ ਸੀਗੀ ਤੁਸੀਂ ਦੱਸ ਸਕਦੇ ਹੋ ਤਾਂ ਆਪਣੇ ਕੋਲ ਕਿਹੜੀ ਕਿਹੜੀ ਕੋਆਲਟੀ ਦੀ ਗੱਡੀ ਹੈ ਅੱਛਾ ਜੀ ਅਤੇ ਜੀ ਜੀ ਸਰ ਮੈਨੂੰ ਦਿੱਲੀ ਨੰਬਰ ਗੱਡੀ ਚਾਹੀਦੀ ਹੈ ਮਤਲਬ ਵਧੀਆ ਕੋਆਲਟੀ ਹੋਵੇ ਅਤੇ ਸਰ ਲੱਗੀ ਲੁੱਗੀ ਨਾ ਹੋਵੇ ਉਹ ਗੱਡੀ ਜੀ ਸਰ ਮਤਲਬ ਆਪਣੇ ਕੋਲ ਸਵਿਫਟ ਗੱਡੀ ਮਿਲ ਜਾਉਗੀ

ਅੱਛਾ ਜੀ ਅਤੇ ਮਤਲਬ ਇਹ ਦੱਸ ਸਕਦੇ ਹੈ ਤੁਸੀਂ ਜੀ ਕਿੰਨੀ ਕੁ ਰੇਂਜ ਹੈ ਜੀ ਸਵਿਫਟ ਗੱਡੀ ਦੀ ਅੱਛਾ ਜੀ ਅਤੇ ਮਤਲਬ ਕਾਗਜ਼ ਪੱਤਰ ਓਕੇ ਹੈ ਜੀ ਉਹਦੇ ਚਲੋ ਕੋਈ ਨਹੀਂ ਸਰ ਮੈਂ ਦੇਖਦਾ ਬਾਕੀ ਸ਼ਾਮ ਨੂੰ ਠੀਕ ਹੈ ਜੀ ਸ਼ਾਮ ਨੂੰ ਆਪਾਂ ਤੁਹਾਡੀ ਏਜੰਸੀ ਜਾ ਕੇ ਫਿਰ ਬੈਠ ਕੇ ਨਾ ਗੱਲ ਕਰ ਲੈਂਦੇ ਹਾਂ ਠੀਕ ਹੈ ਜੀ ਠੀਕ ਹੈ ਸਰ ਜੀ ਚਲੋ ਠੀਕ ਹੈ ਜੀ ਮਿਲਦੇ ਹਾਂ ਫਿਰ ਸ਼ਾਮ ਨੂੰ ਜੀ ਧੰਨਵਾਦ ਜੀ ਧੰਨਵਾਦ ਓਕੇ ਸਰ